ਜੇ ਦੇਖਿਆ ਜਾਵੇ ਤਾਂ ਸਾਡੇ ਰਾਜ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਵਿੱਚ ਪੰਜਾਬੀ ਭਾਸ਼ਾ ਦੀ ਕਾਫੀ ਭੂਮਿਕਾ ਹੈ ਜੇ ਦੇਖਿਆ ਜਾਵੇ ਤਾਂ ਪੰਜਾਬੀ ਭਾਸ਼ਾ ਹੋਰਾਂ ਭਾਸ਼ਾ ਨਾਲੋਂ ਕਾਫੀ ਅਮੀਰ ਜਾਪਦੀ ਹੈ ਜਿਵੇਂ ਅੰਗਰੇਜ਼ੀ ਅੰਗਰੇਜ਼ੀ ਵਿੱਚ ਛੱਬੀ ਅੱਖਰ ਹੁੰਦੇ ਹਨ ਜਿਨ੍ਹਾਂ ਨੂੰ ਅਲਫਾਬੈਟ ਵੀ ਕਿਹਾ ਜਾਂਦਾ ਹੈ ਜਦਕਿ ਪੰਜਾਬੀ ਵਿੱਚ ਪੈਂਤੀ ਅੱਖਰ ਹੁੰਦੇ ਹਨ ਇਸ ਕਰਕੇ ਪੰਜਾਬੀ ਨੂੰ ਪੈਂਤੀ ਅੱਖਰੀ ਵੀ ਕਿਹਾ ਜਾਂਦਾ ਹੈ ਇਸ ਵਿੱਚ ਜ਼ਿਆਦਾ ਅੱਖਰ ਹੋਣ ਕਰਕੇ ਇਹ ਅੰਗਰੇਜ਼ੀ ਤੋਂ ਜ਼ਿਆਦਾ ਅਮੀਰ ਜਾਪਦੀ ਹੈ ਅਤੇ ਅੰਗਰੇਜ਼ੀ ਵਿੱਚ ਅਸੀਂ ਰਿਸ਼ਤੇ ਜਿਵੇਂ ਨਾਨਾ ਨਾਨੀ ਮਾਮਾ ਮਾਸੀ ਆਦਿ ਸਭ ਨੂੰ ਕੇਵਲ ਦੋ ਹੀ ਨਾਮਾਂ ਤੋਂ ਪੁਕਾਰਦੇ ਹਨ ਅੰਕਲ ਆਂਟੀ ਪ੍ਰੰਤੂ ਪੰਜਾਬੀ ਭਾਸ਼ਾ ਵਿੱਚ ਤਰ੍ਹਾਂ ਤਰ੍ਹਾਂ ਦੇ ਰਿਸ਼ਤਿਆਂ ਦੇ ਤਰ੍ਹਾਂ ਤਰ੍ਹਾਂ ਦੇ ਨਾਮ ਹਨ ਇਸ ਕਰਕੇ ਪੰਜਾਬੀ ਭਾਸ਼ਾ ਹੋਰਨਾਂ ਭਾਸ਼ਾ ਨਾਲੋਂ ਕਾਫੀ ਅਮੀਰ ਜਾਪਦੀ ਹੈ ਅਤੇ ਇਹ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਵਿੱਚ ਕਾਫੀ ਭੂਮਿਕਾ ਨਿਭਾਉਂਦੀ ਹੈ ਧੰਨਵਾਦ